ਨੌਂ ਸਤੰਬਰ ਉੱਨੀ ਸੌ ਨੜੇਨਵੇਂ ਵੀਹ ਜੁਲਾਈ ਦੋ ਹਜ਼ਾਰ ਪੰਜ ਜੂਨ ਦੋ ਹਜ਼ਾਰ ਪੰਜ ਵੀਹ ਫ਼ਰਵਰੀ ਦੋ ਹਜ਼ਾਰ ਵੀਹ ਇੱਕੀ ਅਪ੍ਰੈਲ ਦੋ ਹਜ਼ਾਰ ਤੇਈ